ਸਾਨੂੰ ਸਰੀਰ ਵਾਸਤੇ ਯੋਗਾ ਕਰਨਾ ਜ਼ਰੂਰੀ ਹੈਗਾ ਸਰੀਰ ਦੀਆਂ ਮਾਸਪੇਸ਼ੀਆਂ ਠੀਕ ਰਹਿੰਦੀਆਂ ਨੇ ਉਨ੍ਹਾਂ 'ਚ ਲਚਕ ਆਈ ਰਹਿੰਦੀ ਹੈਗੀ ਅਤੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਯੋਗਾ ਕਰਨ ਨਾਲ ਸਰੀਰ 'ਚ ਮਾਨਸਿਕ ਤੌਰ 'ਤੇ ਤੰਦਰੁਸਤੀ ਆਉਂਦੀ ਹੈ ਸਰੀਰ 'ਚ ਤਾਜ਼ਾ ਤਾਜ਼ਾ ਮਹਿਸੂਸ ਕਰਦਾ ਹੈ ਨਾਲ ਬਿਮਾਰੀਆਂ ਤੋਂ ਰਹਿਤ ਮਿਲਦੀ ਹੈ ਨਾਲ ਪੇਟ ਦੀ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਯ ਯੋਗਾ ਕਰਨ ਨਾਲ ਸੈਰ ਕਰਨ ਨਾਲ ਸੈਰ ਕਰੋ ਸ਼ਾਮ ਸਵੇਰੇ ਸਹੇਲੀਆਂ ਨੂੰ ਨ ਵੀ ਲੈ ਕੇ ਜਾਓ ਕਹੋ ਵੀ ਸਰੀਰ ਠੀਕ ਰਹਿੰਦਾ ਲੱਤਾਂ ਵੀ ਠੀਕ ਰਹਿੰਦੀਆਂ ਨੇਗੀਆਂ ਉਨ੍ਹਾਂ ਦੇ ਨਾਲ ਸੈਰ ਕਰਨ ਦੇ ਨਾਲ ਨਾਲ ਨ ਮਨ ਵੀ ਸ਼ਾਂਤ ਰਹਿੰਦਾ ਗਾ ਕੰਮ ਕਰਨ 'ਚ ਜੀਅ ਲੱਗਦਾ ਗਾ ਰੋਜ਼ਾਨਾ ਦੇ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਜਿਵੇਂ ਬੀ ਪੀ ਵਗੈਰਾ ਸੂਗਰ ਡਾਇਬਟੀ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈਗਾ ਨਾਲ ਨਾਲ ਆਪਣੇ ਮਨੋਰੰਜਨ ਵੀ ਹੋ ਜਾਂਦਾ ਬਾਹਰ ਅੰਦਰ ਜਦੋਂ ਬੰਦਾ ਜਾਂਦਾ ਹੈ ਸਹੇਲੀਆਂ ਦੋਸਤਾਂ ਮਿੱਤਰਾਂ ਨੂੰ ਮਿਲਦਾ ਹੈ ਉਨ੍ਹਾਂ ਨਾਲ ਜਾਣ ਪਛਾਣ ਹੁੰਦੀ ਹੈ ਅਗਾਂਹ ਦੀ ਅਗਾਂਹ ਉਨ੍ਹਾਂ ਦੀ ਨਾਲ ਮਿਲ ਜੁਲ ਕੇ ਕੰਮ ਕਰਨ ਦਾ ਟੈਮ ਵੀ ਮਿਲਦਾ ਹੈ ਮਾਨਸਿਕ ਤੌਰ 'ਤੇ ਵੀ ਬੰਦਾ ਫਿਰ ਖੁਸ਼ ਰਹਿੰਦਾ ਹੈਗਾ ਨਾਲ ਕੰਮ ਕਰਦਾ ਹੈ ਨਾਲ ਸਰੀਰ ਠੀਕ ਰਹਿੰਦਾ ਹੈਗਾ ਬਾਕੀ ਟੈਮ ਸਪੈਂਡ ਕਰਨ ਨਾਲ ਅੰਦਰੂਨੀਆਂ ਬਿਮਾਰੀਆਂ ਅੰਗਾਂ ਨੂੰ ਮਜਬੂਤੀ ਮਿਲਦੀ ਐਗੀ ਜਿਹਦੇ ਬੰਦਾ ਕੰਮ ਦੇ ਵਿੱਚ ਲੱਗਿਆ ਰਹਿੰਦਾ ਹੈ ਸਾਰੀ ਮਸ਼ੀਨਰੀ ਕੰਮ ਕਰਦੀ ਰਹਿੰਦੀ ਹੈ ਰੁਕਦੀ ਨਹੀਂ ਹੈਗੀ ਮਸ਼ੀਨਰੀ ਜੇ ਕੰਮ ਕਰਦੀ ਹੋਵੇਗੀ ਤਾਂ ਬੰਦਾ ਕੰਮ ਕਰੂਗਾ ਜੇ ਨਹੀਂ ਕੰਮ ਕਰੂਗਾ ਤਾਂ ਮਸ਼ੀਨਰੀ ਖੜ੍ਹ ਜੂਗੀ ਤੇਲ 'ਤੇ ਗੱਡੀ ਵਾਲਾ ਹਿਸਾਬ ਹੈ ਜੇ ਗੱਡੀ ਚੱਲਦੀ ਰਹਿੰਦੀ ਹੈ ਤਾਂ ਗੱਡੀ ਚੱਲਦੀ ਰਹਿੰਦੀ ਹੈ ਜੇ ਉਹਦੇ ਵਿੱਚ ਤੇਲ ਨਾਲ ਪਾਈਏ ਤਾਂ ਗੱਡੀ ਖੜ੍ਹ ਜਾਂਦੀ ਹੈ ਉਹ ਹੀ ਹਿਸਾਬ ਮਸ਼ੀਨ ਆਪਣੇ ਸਰੀਰ ਦੀ ਮਸ਼ੀਨਰੀ ਹੈ ਜੇ ਆਪਾਂ ਕੰਮ ਕਰਾਂਗੇ ਰੋਜ਼ਾਨਾ ਘਰ ਦੇ ਕੰਮ ਕਰਾਂਗੇ ਉਹ ਵੀ ਕਸਰਤ ਦੇ ਸਮਾਨ ਹੈ ਜਿਹੜਾ ਘਰ ਦਾ ਕੰਮ ਕਰਨਾ ਹੈ ਰੋਜ਼ ਝਾੜੂ ਪੋਚਾ ਲਾਉਣਾ ਉਹ ਵੀ ਕਸਰਤ ਹੈ ਕੰਮ ਔਰਤਾਂ ਲਈ ਠੀਕ ਹੈ ਅਤੇ ਰੋਜ਼ਾਨਾ ਕੰਮ ਦੇ ਵਿੱਚ ਨ ਜਿਵੇਂ ਨਹਾਉਣਾ ਇਹ ਵੀ ਇੱਕ ਉਹ ਹੈਗੀ ਰੋਜ਼ਾਨਾ ਨਹਾਉਣਾ ਇਹ ਕਸਰਤ ਐਗੀ ਸਰੀਰ ਦੇ ਅੰਗਾਂ ਦੀ ਮਾਲਸ਼ ਕਰਨੀ ਕਸਰਤ ਐਗੀ ਬਿਮਾਰੀਆਂ ਤੋਂ ਰਹਿਤ ਮਿਲਦੀ ਹੈ ਹੱਡਾਂ 'ਚ ਲਚਕ ਮਿਲੀ ਰਹਿੰਦੀ ਹੈ ਮਾਸਪੇਸ਼ੀਆਂ ਠੀਕ ਰਹਿੰਦੀਆਂ ਨੇ ਠੀਕ ਹੈ